ਪੰਜਾਬ ਸਰਕਾਰ ਨੇ ਪੰਜਾਬੀ ਭਾਸ਼ਾ ਲਈ ਬਹੁਤ ਉਪਰਾਲੇ ਕੀਤੇ ਹਨ ਥਾਂ ਥਾਂ ਲਾਇਬ੍ਰੇਰੀਆਂ ਜਿਨ੍ਹਾਂ ਵਿੱਚ ਅੱਛੀਆਂ ਕਿਤਾਬਾਂ ਪੰਜਾਬੀ ਪੜ੍ਹਨ ਲਈ ਬੱਚਿਆਂ ਨੂੰ ਮਿਲਦੀਆਂ ਹਨ ਸਿੱਖਣ ਲਈ ਬਹੁਤ ਕੁਝ ਮਿਲਦਾ ਹੈ ਰਸਾਲੇ ਜਾਰੀ ਕੀਤੇ ਹਨ ਜਿਹੜਾ ਸਾਨੂੰ ਪੰਜਾਬੀ ਬਹੁਤ ਅੱਛੀ ਪੜ੍ਹਨੀ ਉਹਦੇ ਵਿੱਚ ਅੱਛੀ ਸਿੱਖਿਆ ਲਈ ਬਹੁਤ ਸਹਿਯੋਗ ਮਿਲਦਾ ਹੈ ਸਹਿਯੋਗ ਪ੍ਰੋਗਰਾਮ ਕੀਤੇ ਜਾਂਦੇ ਹਨ ਸਕੂਲ ਕਾਲਜ ਵਿੱਚ ਪ੍ਰੋਗਰਾਮ ਨਵੇਂ ਨਵੇਂ ਪ੍ਰੋਜ਼ੈਕਟ ਕੀਤੇ ਜਾਂਦੇ ਹਨ ਪੰਜਾਬੀ ਭਾਸ਼ਾ ਵਿੱਚ ਬੋਲਣ ਲਈ